ਇੱਕ ਲੱਖ ਵੀਹ ਹਜ਼ਾਰ ਦੋ ਲੱਖ ਤੀਹ ਹਜ਼ਾਰ ਚਾਰ ਲੱਖ ਪੰਜਾਹ ਹਜ਼ਾਰ ਛੇ ਲੱਖ ਸੱਤ ਹਜ਼ਾਰ ਅੱਠ ਲੱਖ ਵੀਹ ਹਜ਼ਾਰ